ਹਾਂਜੀ ਅਸੀਂ ਕਾਰਪੈਂਟਰ ਬੋਲ ਰਹੇ ਹਾਂ ਤੁਹਾਡਾ ਫੋਨ ਆਇਆ ਕਿ ਤੁਸੀਂ ਲੱਕੜ ਦਾ ਕੰਮ ਕਰਵਾਉਣਾ ਸੀ ਹਾਂਜੀ ਦੱਸੋ ਹਾਂਜੀ ਹਾਂਜੀ ਸਾਰਾ ਕਿਚਨ ਤਿਆਰ ਕਰਵਾਉਣ ਦੇ ਵਿੱਚ ਘੱਟ ਤੋਂ ਘੱਟ ਵੀ ਲੱਖ ਤੋਂ ਡੇਢ ਲੱਖ ਰੁਪਏ ਤੱਕ ਦਾ ਖਰਚਾ ਆ ਜਾਊਗਾ ਦੇਖੋ ਤੁਸੀਂ ਤੁਹਾਡੇ 'ਤੇ ਡਿਪੈਂਡ ਆ ਤੁਸੀਂ ਜੇਕਰ ਥੋੜ੍ਹਾ ਜਿਹਾ ਮਟੀਰੀਅਲ ਉਸ ਹਿਸਾਬ ਨਾਲ ਲਾ ਲਓ ਜੇ ਸਸਤਾ ਥੋੜ੍ਹਾ ਜਿਹਾ ਲਾ ਲਓ ਤਾਂ ਤੁਹਾਡਾ ਐਵੇਂ ਬਣ ਜਾਵੇਗਾ ਪਰ ਜੇਕਰ ਤੁਸੀਂ ਜ਼ਿਆਦਾ ਵਧੀਆ ਬਣਾਓਗੇ ਲੱਕੜ 'ਤੇ ਡਿਪੈਂਡ ਕਰਦੇ ਆ ਤੁਸੀਂ ਕਿਹੜੀ ਲੱਕੜ ਯੂਜ ਕਰਨੀ ਆ ਕਿਹੜਾ ਮਟੀਰੀਅਲ ਯੂਜ ਕਰਨਾ ਚਲੋ ਮੈਂ ਆਪਦਾ ਜਿਹੜਾ ਮੇਰਾ ਬਣਦਾ ਜੋ ਮੈਂ ਲੈਣਾ ਹੁੰਦਾ ਹੈ ਪ੍ਰਾਈਜ ਉਹ ਥੋੜ੍ਹਾ ਜਿਹਾ ਘੱਟ ਕਰਕੇ ਘੱਟ ਤੋਂ ਘੱਟ ਵੀ ਫਿਰ ਵੀ ਲੱਖ ਨੱਬੇ ਕ ਹਜ਼ਾਰ ਤੱਕ ਤਾਂ ਬਣੂੰਗਾ ਹੀ ਨੱਬੇ ਹਜ਼ਾਰ ਤੱਕ ਤਾਂ ਲੱਗ ਹੀ ਜਾਏਗਾ ਸਾਰਾ ਆਪਣਾ ਸਮਾਨ ਸਮੁਨ ਕਰਕੇ ਜੇਕਰ ਤੁਹਾਡੀ ਹੈਲਪ ਕਰਾਂ ਮੈਂ ਚੰਗੀ ਤਰ੍ਹਾਂ ਕਿਹੜਾ ਸਮਾਨ ਲੈਣਾ ਸਸਤੇ ਤੋਂ ਆਪਾਂ ਘੱਟ ਪ੍ਰਾਈਜ ਵਾਲੇ ਲੈਣਾ ਤਾਂ ਵੀ ਹਾਂਜੀ ਉਹਦੀ ਘੱਟ ਤੋਂ ਘੱਟ ਵੀ ਦੋ ਤੋਂ ਲੈ ਕੇ ਤਿੰਨ ਸਾਲ ਤੱਕ ਦੀ ਗਰੰਟੀ ਹੋਵੇਗੀ ਬਿਲਕੁਲ ਖਰਾਬ ਨਹੀਂ ਹੁੰਦਾ ਅਤੇ ਜਿਹੜਾ ਵੀ ਆਪਾਂ ਲੱਕੜ ਯੂਜ ਕਰਨੀ ਉਹ ਵਧੀਆ ਰਹੇਗੀ ਖਰਾਬ ਬਿਲਕੁਲ ਨਹੀਂ ਹੋਵੇਗੀ ਜੇ ਕਿਤੇ ਖਰਾਬ ਹੋਜੇ ਜਾਂ ਆਪਾਂ ਜਿਹੜਾ ਵੀ ਮਟੀਰੀਅਲ ਯੂਜ ਕਰਨਾ ਉਹ ਬਿਲਕੁਲ ਸਹੀ ਰਹੇਗਾ ਕੋਈ ਗੱਲ ਨਹੀਂ ਜੀ ਤੁਸੀਂ ਬਸ ਬੇਫਿਕਰ ਰਹੋ ਬਸ ਤੁਸੀਂ ਸਾਨੂੰ ਦੱਸੋ ਕਦੋਂ ਕੰਮ ਕਰਨਾ ਅਸੀਂ ਤਾਂ ਤਿਆਰ ਹੀ ਹਾਂ ਹਾਂਜੀ ਅਸੀਂ ਬਹੁਤ ਕੰਮ ਕੀਤੇ ਸ਼ਹਿਰਾਂ 'ਚ ਵੀ ਪਿੰਡਾਂ 'ਚ ਵੀ ਸਾਡੇ ਕੋਲ ਬਹੁਤ ਸਾਰੀਆਂ ਫੋਟੋਆਂ ਹੈਗੀਆਂ ਨੇ ਕੰਮ ਕਾ ਤਿਆਰ ਕੀਤੇ ਨੇ ਕੋਈ ਗੱਲ ਨਹੀਂ ਅਸੀਂ ਤੁਹਾਨੂੰ ਵਿਖਾਵਾਂਗੇ ਜਦੋਂ ਤੁਸੀਂ ਸਾਡੇ ਕੋਲ ਆਓਗੇ ਇੱਥੇ ਸਾਡੇ ਦੁਕਾਨ 'ਤੇ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ

ਬਸ ਅਸੀਂ ਹੁਣ ਥੋੜ੍ਹਾ ਜਿਹਾ ਕਿਤੇ ਹੋਰ ਕੰਮ ਲੱਗਿਆ ਹੋਇਆ ਬਸ ਇੱਕ ਦੋ ਦਿਨਾਂ ਤੱਕ ਤੁਸੀਂ ਸਾਡੇ ਸੰਪਰਕ ਕਰੋ ਅਤੇ ਆਪਾਂ ਸਮਾਨ ਲਿਆ ਕੇ ਅਤੇ ਆਪਾਂ ਤੁਹਾਡਾ ਕੰਮ ਸਟਾਰਟ ਕਰ ਦਿੰਦੇ ਹਾਂ ਹਾਂਜੀ ਮੈਨੂੰ ਇੱਕ ਦੋ ਦਿਨ ਲੱਗਣਗੇ ਸਰ ਮੈਂ ਤੁਹਾਡੇ ਪਰਿਵਾਰ ਤੋਂ ਜ਼ਰੂਰ ਵੇਖ ਕੇ ਅਤੇ ਮੈਂ ਤੁਹਾਨੂੰ ਦੱਸ ਦਾਂਗੀ ਕਿੰਨਾ ਕੁ ਟਾਈਮ ਲੱਗੇਗਾ ਕਿਚਨ ਤੁਹਾਡਾ ਕਿੰਨਾ ਕੁ ਵੱਡਾ ਸਾਰਾ ਆਪਾਂ ਨੂੰ ਏਰੀਆ ਤਾਂ ਕਵਰ ਕਰਨਾ ਹੀ ਪੈਣਾ ਕਿ ਲੱਗਦਾ ਬਾਕੀ ਕੋਈ ਗੱਲ ਨਹੀਂ ਆਪਾਂ ਜਦੋਂ ਮਿਲਾਂਗੇ ਫਿਰ ਤੁਹਾਡਾ ਸਾਰਾ ਕੰਮ ਹੋ ਜਾਵੇਗਾ ਅਤੇ ਹਾਂਜੀ ਕੋਈ ਗੱਲ ਨਹੀਂ ਅਸੀਂ ਬਸ ਤੁਹਾਡੇ ਘਰ ਆ ਕੇ ਅਤੇ ਤੁਹਾਡਾ ਸਾਰੀ ਰਸੋਈ ਦਾ ਪਹਿਲਾਂ ਵੇਖ ਲਵਾਂਗੇ ਕਿੱਥੇ ਕਿਵੇਂ ਕਿਹੜਾ ਮਟੀਰੀਅਲ ਲੱਗਣਾ ਫਿਰ ਆਪਾਂ ਨਾਲ ਦੀ ਨਾਲ ਕੰਮ ਸਟਾਰਟ ਕਰ ਦਾਂਗੇ ਹੈਲੋ ਹਾਂਜੀ